ਹੈਲੋ ਮੈਂ ਰੀਤੂ ਬਾਲਾ ਢੇਸੀਆਂ ਤੋਂ ਹਾਂਜੀ ਸਰ ਬਾਕੀ ਸਾਡੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਜ਼ਰੂਰ ਬੋਲਣੀ ਚਾਹੀਦੀ ਹੈ ਹਾਂਜੀ ਸਾਡੇ ਪੰਜਾਬੀ ਭਾਸ਼ਾ ਸਾਡੇ ਦੇਸ਼ ਵਿੱਚ ਸਕੂਲਾਂ ਵਿੱਚ ਵੀ ਪੜ੍ਹਾਉਣੀ ਚਾਹੀਦੀ ਹੈ ਅਤੇ ਸਾਡੇ ਪੰਜਾਬੀ ਭਾਸ਼ਾ ਹਰ ਇੱਕ ਜਾਣੇ ਨੂੰ ਹੀ ਆਉਣੀ ਚਾਹੀਦੀ ਹੈ ਅਤੇ ਸਾਡੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਹੀ ਚੱਲਦੀ ਹੈ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਹੀ ਬੋਲਣੀ ਚਾਹੀਦੀ ਹੈ ਅਤੇ ਹਰ ਸਕੂਲ ਵਿੱਚ ਪੰਜਾਬੀ ਹੀ ਸਿਖਾਉਣੀ ਚਾਹੀਦੀ ਹੈ ਹਰ ਬੱਚੇ ਨੂੰ ਪੰਜਾਬੀ ਆਉਣੀ ਚਾਹੀਦੀ ਹੈ ਅਤੇ ਜਿੱਥੇ ਵੀ ਜਾਈਏ ਅਤੇ ਪੰਜਾਬੀ ਬੋਲੀਏ ਸਾਡੀ ਮਤਲਬ ਕਿ ਪੰਜਾਬੀ ਹੀ ਠੀਕ ਹੈ ਪੰਜਾਬ ਵਿੱਚ ਪੰਜਾਬੀ ਹੀ ਚੱਲਦੀ ਹੈ ਪੰਜਾਬੀ ਜ਼ਰੂਰੀ ਹੈ ਬੋਲਣਾ ਅਤੇ ਸਿੱਖਣਾ ਅਤੇ ਸਿਖਾਉਣਾ ਪਰ ਜੇ ਪੰਜਾਬੀ ਨਹੀਂ ਆਉਂਦੀ ਤਾਂ ਇੱਕ ਦੂਜੇ ਕੋਲੋਂ ਸਕੂਲ 'ਚ ਵੀ ਪੜ੍ਹਾਉਣੀ ਚਾਹੀਦੀ ਹੈ ਅਤੇ ਜ਼ਰੂਰ ਆਉਣੀ ਚਾਹੀਦੀ ਹੈ ਸਾਡੇ ਪੰਜਾਬ ਵਿੱਚ ਹੀ ਪੰਜਾਬੀ ਭਾਸ਼ਾ ਚੱਲਣੀ ਚਾਹੀਦੀ ਹੈ